ਮੈਂ ਆਪਣੇ ਚੱਲਣ ਵਾਲੇ ਜੁੱਤੇ ਜਿਹੜੇ ਆ ਉਹ ਕੌਂਪਨੀ ਦੇ ਪਸੰਦ ਕਰਦਾ ਹਾਂ ਉਹਨਾਂ ਨੂੰ ਮੈਂ ਤਾਂ ਕਰਕੇ ਤਰਜੀਹ ਦਿੰਦਾ ਹਾਂ ਕਿ ਉਹ ਇੱਕ ਤਾਂ ਸੋਫਟ ਬਹੁਤ ਹੁੰਦੇ ਹੈ ਪੈਰਾਂ ਨੂੰ ਜ਼ਿਆਦਾ ਉਹ ਨੁਕਸਾਨ ਨਹੀਂ ਕਰਦੇ ਦੂਜਾ ਉਹਨਾਂ ਦਾ ਇਹ ਹੈ ਕਿ ਉਹ ਜ਼ਿਆਦਾ ਭਾਰੇ ਨਹੀਂ ਹੁੰਦੇ ਅਤੇ ਜਦੋਂ ਵੀ ਮੈਂ ਬਾਹਰ ਅੰਦਰ ਜਾਂਦਾ ਹਾਂ ਤਾਂ ਮੈਂ ਉਹੀ ਪਹਿਨ ਕੇ ਜਾਂਦਾ ਹਾਂ ਕਿਉਂਕਿ ਮੇਰੇ ਪੈਰਾਂ ਨੂੰ ਨਾ ਤਾਂ ਜ਼ਿਆਦਾ ਉਹਨਾਂ ਨਾਲ ਪਸੀਨਾ ਆਉਂਦਾ ਹੈ ਨਾ ਪੈਰਾਂ ਦੇ ਵਿੱਚੋਂ ਉਹਨਾਂ 'ਚੋਂ ਬਦਬੂ ਜ਼ਿਆਦਾ ਆਉਂਦੀ ਹੈ ਤਾਂ ਕਰਕੇ ਮੈਂ ਇਹਨਾਂ ਨੂੰ ਜ਼ਿਆਦਾ ਪਸੰਦ ਕਰਦਾ ਹਾਂ ਅਤੇ ਸਾਡੇ ਕੋਲ ਖੇਡਣ ਵਾਲੇ ਕੱਪੜੇ ਉਹ ਵੀ ਅਸੀਂ ਲੈ ਕੇ ਆਉਂਦੇ ਆ ਇਸ ਤੋਂ ਇਲਾਵਾ ਅਸੀਂ ਹੋਰ ਵੀ ਕਈ ਵਾਰ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਅਸੀਂ ਟੀ ਸ਼ਰਟ ਅਤੇ ਕੈਪਰੀ ਪਾ ਕੇ ਵੀ ਅਸੀਂ ਐਕਸਰਸਾਈਜ਼ ਕਰਦੇ ਹਾਂ ਖੇਡਦੇ ਹਾਂ ਕਿਉਂਕਿ ਉਹਨਾਂ ਵਿੱਚ ਥੋੜ੍ਹਾ ਆਰਾਮ ਹੁੰਦਾ ਹੈ ਅਤੇ ਜਿਹੜੇ ਜਿਹੜਾ ਪਹਿਰਾਵਾ ਸਾਡਾ ਉਹ ਅਸੀਂ ਥੋੜ੍ਹਾ ਜਿਹਾ ਖੁੱਲ੍ਹੇ ਡੁੱਲੇ ਕੱਪੜੇ ਪਾ ਕੇ ਉਹਦੇ ਨਾਲ ਅਸੀਂ ਰਾਹਤ ਮਹਿਸੂਸ ਕਰਦੇ ਹਾਂ ਕਿਉਂਕਿ ਉਹਦੇ ਨਾਲ ਸਾਨੂੰ ਬਹੁਤ ਆਰਾਮ ਮਿਲਦਾ ਹੈ